ਪੰਜਾਬ ਸਿਹਤ ਸੰਭਾਲ ਦੀ ਖੋਜ ਜਾਣੀ ਕਿ ਜਿਵੇਂ ਕਿ ਕੁਦਰਤ ਵੱਲੋਂ ਸਮਾਂ ਪੈਣ 'ਤੇ ਜਿਵੇਂ ਕਿ ਭੁਚਾਲ ਆ ਗਿਆ ਹੜ੍ਹ ਆ ਗਿਆ ਜਾਂ ਸਰਦੀ ਆ ਗਈ ਜਾਂ ਗਰਮੀ ਆ ਗਈ ਉਹਦੇ ਵਿੱਚ ਸਾਨੂੰ ਆਪਣੇ ਆਪ 'ਤੇ ਫੀਲ ਹੋਣਾ ਮਹਿਸੂਸ ਹੋ ਜਾਂਦਾ ਹੈ ਕਿ ਸਿਹਤ ਨੂੰ ਸੰਭਾਲੋ ਸਿਹਤ ਸੰਭਾਲਣ ਲਈ ਸਾਨੂੰ ਕੁਛ ਕਲੀਨਿਕ ਦੀ ਲੋੜ ਪੈਂਦੀ ਹੈ ਕੁਛ ਦੇਸੀ ਦਵਾਈਆਂ ਦੀ ਲੋੜ ਪੈਂਦੀ ਹੈ ਅਤੇ ਉਹ ਤੋਂ ਬਾਅਦ ਮਹਾਂਮਾਰੀ ਵਿਗਿਆਨੀ ਕਈ ਵਾਰੀ ਸਾਨੂੰ ਅਖ਼ਬਾਰਾਂ ਰਾਹੀਂ ਰੇਡੀਓ ਰਾਹੀਂ ਜਾਂ ਟੈਲੀਵਿਜ਼ਨਾਂ ਰਾਹੀਂ ਦੱਸ ਦਿੰਦੇ ਨੇ ਵੀ ਹੁਣ ਇਹ ਕੁਛ ਹੋਣ ਵਾਲਾ ਇਹ ਜਿਵੇਂ ਕਿ ਹੁਣ ਬਲਾ ਫਲੂ ਸ਼ੁਰੂ ਹੋ ਗਿਆ ਅੱਖਾਂ ਦੀ ਬਿਮਾਰੀ ਆ ਗਈ ਅਤੇ ਉਹਨੂੰ ਕਹਿੰਦੇ ਸੀ ਫਲੂ ਆ ਗਿਆ ਅਤੇ ਉਹਦੀ ਸੰਭਾਲਣ ਵਾਸਤੇ ਅਸੀਂ ਪਹਿਲਾਂ ਹੀ ਉਸਦਾ ਉਸਦਾ ਟਰੀਟਮੈਂਟ ਚੱਲ ਕਰਵਾਉਣਾ ਸ਼ੁਰੂ ਕਰ ਲੈਂਦੇ ਹਾਂ ਜਾਂ ਆਪਣੇ ਆਪ ਆਪਣੀ ਸਿਹਤ ਦਾ ਸੰਭਾਲ ਕਰ ਲੈਂਦੇ ਹਾਂ